ਮੈਂ ਮਾਨਸਾ ਦੀ ਰਹਿਣ ਵਾਲੀ ਹਾਂ ਮੈਂ ਆਪਣੀ ਸਕੂਲਿੰਗ ਬਾਲਿਕਾ ਉੱਚ ਮਾਧਿਅਮਿਕ ਸਕੂਲ ਤੋਂ ਕੀਤੀ ਮੈਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ ਸਾਡੇ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਬਹੁਤ ਐਕਟੀਵਿਟੀਜ਼ ਹੁੰਦੀਆਂ ਹੈ ਜਿਹਨਾਂ ਵਿੱਚੋਂ ਸਿੰਗਿੰਗ ਵੀ ਇੱਕ ਐਕਟੀਵਿਟੀ ਸੀ ਅਤੇ ਮੈਨੂੰ ਸਿੰਗਿੰਗ ਵਿੱਚ ਇੰਟਰਸਟ ਹੋਣ ਕਰਕੇ ਮੈਂ ਵੀ ਸਿੰਗਿੰਗ ਕਲਾਸਿਸ ਲਗਾਉਂਦੀ ਸੀ ਸਾਡੇ ਸਕੂਲ ਵਿੱਚ ਗੁਰਜੀਤ ਮੈਡਮ ਸਨ ਉਹ ਸਾਨੂੰ ਸਿੰਗਿੰਗ ਸਿਖਾਉਂਦੇ ਸਨ ਉਹਨਾਂ ਨੇ ਸਿੰਗ ਸਾਨੂੰ ਸਿੰਗਿੰਗ ਬਾਰੇ ਸ਼ੁਰੂ ਤੋਂ ਬਹੁਤ ਵਧੀਆ ਤਰੀਕੇ ਤੋਂ ਸਮਝਾਇਆ ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਸਾਰੇ ਸੁਰਾਂ ਅਤੇ ਰਾਗਾਂ ਬਾਰੇ ਦੱਸਿਆ ਤਾਂ ਕਿ ਸਾਡੀ ਸਿੰਗਿੰਗ ਸਟਾਰਟਿੰਗ ਤੋਂ ਹੀ ਵਧੀਆ ਹੋ ਜਾਏ ਉਹਨਾਂ ਨੇ ਸਾਨੂੰ ਸਿ ਨਾ ਸਿਰਫ ਸ਼ੁਰੂ ਤੋਂ ਅਤੇ ਰਾਗ ਸੁਰਾਂ ਅਤੇ ਰਾਗ ਬਾਰੇ ਦੱਸਿਆ ਬਲਕਿ ਸਾਨੂੰ ਸਿੰਗਿੰਗ ਅਤੇ ਮਿਊਜ਼ਿਕ ਨਾਲ ਜੁੜੇ ਇੰਸਟਰੂਮੈਂਟਸ ਬਾਰੇ ਵੀ ਦੱਸਿਆ ਜਿਹਨਾਂ ਵਿੱਚੋਂ ਗਿਟਾਰ ਅਤੇ ਹਰਮੋਨੀਅਮ ਵਜਾਉਣਾ ਵੀ ਸਿਖ ਵਜਾ ਵੀ ਸਨ ਉਹਨਾਂ ਨੇ ਸਾਨੂੰ ਗਿਟਾਰ ਅਤੇ ਹਰਮੋਨੀਅਮ ਵਜਾਉਣਾ ਵੀ ਸਿਖਾਇਆ ਅਤੇ ਉਹਨਾਂ ਵਿੱਚ ਕਿਸ ਤਰ੍ਹਾਂ ਤੋਂ ਮਿਊਜ਼ਿਕ ਦਿੱਤਾ ਦਿੱਤਾ ਜਾਂਦਾ ਹੈ ਉਹ ਵੀ ਸਾਨੂੰ ਸਮਝਾਇਆ ਉਹਨਾਂ ਦਾ ਮੇਰੇ ਸਿੰਗਿੰਗ ਲਾਈਫ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਹੈ ਜੇ ਉਹ ਮੇਰੀ ਲਾਈਫ 'ਚ ਨਾ ਹੁੰਦੇ ਤਾਂ ਮੈਂ ਕਦੇ ਵੀ ਸਿੰਗਿੰਗ ਵਿੱਚ ਅੱਗੇ ਨਹੀਂ ਵਧ ਸਕਣਾ ਸੀ ਉਹਨਾਂ ਕਰਕੇ ਹੀ ਮੈਂ ਆਪਣੀ ਸਿੰਗਿੰਗ ਲਾਈਫ 'ਚ ਬਹੁਤ ਅਵਾਰਡ ਜਿੱਤੇ ਅਤੇ ਬਹੁਤ ਨਾਮ ਕਮਾਇਆ ਅਤੇ ਮੇਰੀ ਲਾਈਫ 'ਚ ਮੇਰੀ ਟੀਚਰ ਨਾ ਹੁੰਦੇ ਤਾਂ ਮੈਨੂੰ ਸਿੰਗਿੰਗ ਸਿਖਾਉਣ ਲਈ ਜੇ ਉਹ ਮੇਰੀ ਲਾਈਫ 'ਚ ਨਾ ਹੁੰਦੇ ਤਾਂ ਮੈਂ ਨਾ ਕਿ ਕਦੇ ਸਿੰਗਿੰਗ 'ਚ ਆਪਦੇ ਇੰਟਰਸਟ ਨਾ ਨੂੰ ਆਪਦਾ ਪੈਸ਼ਨ ਬਣਾ ਸਕਦੀ ਅਤੇ ਨਾ ਹੀ ਕਦੇ ਸਿੱਖ ਸਕਦੀ ਅਤੇ ਨਾ ਹੀ ਮੈਂ ਇੰਨੇ ਸਾਰੇ ਅਵਾਰਡ ਜਿੱਤ ਸਕਦੀ